ਅੱਜ ਕੱਲ੍ਹ ਮੈਂ ਬਹੁਤ ਅਲੱਗ ਅਲੱਗ ਤਰ੍ਹਾਂ ਦੇ ਪਿਕਨਿਕ ਮਨਾਉਣ ਜਾਂਦਾ ਆਪਣੇ ਦੋਸਤਾਂ ਨਾਲ ਪਰ ਜ਼ਿਆਦਾਤਰ ਮੈਂ ਪਿਕਨਿਕ ਮਨਾਉਣ ਪਹਾੜ 'ਤੇ ਜਾਂਦਾ ਏ ਕਿਉਂਕਿ ਪਹਾੜ 'ਤੇ ਜਿਹੜੀ ਹਵਾ ਹੁੰਦੀ ਆ ਉਹ ਬਹੁਤ ਜ਼ਿਆਦਾ ਫਰੈਸ਼ ਹੁੰਦੀ ਆ ਅਤੇ ਜ਼ਿਆਦਾਤਰ ਮੈਂ ਪਿਕਨਿਕ ਮਨਾਉਣ ਵੀਕਐਂਡਸ 'ਤੇ ਜਾਂਦਾ ਆਪਣੀ ਫੈਮਲੀ ਦੇ ਨਾਲ ਕਿਉਂਕਿ ਅੱਜ ਕੱਲ੍ਹ ਸਾਰੀ ਜਗ੍ਹਾ ਹੁੰਦੀਆਂ ਕਿੱਥੇ ਪੂਰੀ ਪਾਪੁਲੇਸ਼ਨ ਭਰੀ ਹੋਵੇ ਉਹਦੇ ਕਰਕੇ ਉੱਥੇ ਇਰੀਟੇਸ਼ਨ ਬਹੁਤ ਹੁੰਦੀ ਆ ਪਰ ਜੇ ਲੋਕ ਪਿਕਨਿਕ ਪਹਾੜ 'ਤੇ ਮਨਾਉਣ ਜਾਉਗੇ ਅਤੇ ਉੱਥੇ ਜਾ ਕੇ ਬਹੁਤ ਬਹੁਤ ਅਲੱਗ ਅਲੱਗ ਤਰੀਕੇ ਦੀ ਚੀਜ਼ਾਂ ਕਰ ਸਕਦੇ ਆ ਪਰ ਜ਼ਿਆਦਾਤਰ ਮੇਰਾ ਮੇਨ ਰੀਜ਼ਨ ਆਹ ਏ ਕਿ ਮੈਂ ਪਿਕਨਿਕ ਪਹਾੜ 'ਤੇ ਮਨਾਉਣ ਜਾਂਦਾ ਕਿਉਂਕਿ ਉੱਥੇ ਹਮੇਸ਼ਾਂ ਫਰੈਸ਼ ਏਅਰ ਹੁੰਦੀ ਹੈ ਕਿਹਦੇ ਕਰਕੇ ਮੇਰਾ ਦਿਮਾਗ ਹਮੇਸ਼ਾ ਕੂਲ ਰਹਿੰਦਾ ਏ